ਪਠਾਨਕੋਟ ਦੇ ਲੋਕ ਮਨੋਰੰਜਨ ਅਤੇ ਮਨਮੋਹਕ ਗਤੀਆਂ ਵਿਧੀਆਂ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ ਅਤੇ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਇਸ ਦੇ ਨਾਲ ਨਾਲ ਪਠਾਨਕੋਟ ਜ਼ਿਲ੍ਹੇ ਵਿੱਚ ਖੇਡਾਂ ਅਤੇ ਮਨੋਰੰਜਨ ਬਹੁਤ ਜ਼ਿਆਦਾ ਪ੍ਰਸਿੱਧ ਹਨ ਜਿਸ ਵਿੱਚ ਆਉਂਦੀ ਹੈ ਸਾਡੀ ਕ੍ਰਿਕਟ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਅਸੀਂ ਬੈਟ ਅਤੇ ਬੋਲ ਨਾਲ ਖੇਡਦੇ ਹਾਂ ਇਹ ਬੱਚਿਆਂ ਦੇ ਮਨ ਨੂੰ ਬਹੁਤ ਜ਼ਿਆਦਾ ਮੋਹ ਲੈਂਦਾ ਹੈ ਅਤੇ ਨਾਲ ਹੀ ਨਾਲ ਵੱਡੇ ਵੀ ਇਸ ਖੇਡ ਨੂੰ ਪਸੰਦ ਕਰਦੇ ਹਨ ਇਸ ਦੇ ਨਾਲ ਨਾਲ ਕਬੱਡੀ ਜਾਂ ਕੁਸ਼ਤੀ ਜਿਹੀ ਅਜਿਹੀਆਂ ਖੇਡਾਂ ਵੀ ਹੁੰਦੀਆਂ ਹਨ ਜੋ ਇੱਥੇ ਖੇਡੀਆਂ ਜਾਦੀਆਂ ਨੇ ਇਸ ਕਰਕੇ ਇੱਥੋਂ ਦੇ ਇਹ ਸਥਾਨਕ ਖੇਡਾਂ ਦੇ ਬਰਾਬਰ ਹੀ ਹਨ ਕੁਸ਼ਤੀ ਕਰਨ ਵੇਲੇ ਆ ਸਿਰਫ ਮੁੰਡਿਆਂ ਦੀ ਹੀ ਖੇਡਾਂ ਦੇਖੀਆਂ ਜਾਂਦੀਆਂ ਹਨ ਜਦੋਂ ਕਿ ਕਬੱਡੀ ਵਗੈਰਾ ਕੁੜੀਆਂ ਵੀ ਖੇਡ ਸਕਦੀਆਂ ਹਨ ਅਜਿਹੀਆਂ ਖੇਡਾਂ ਕੁੜੀਆਂ ਅਤੇ ਮੁੰਡਿਆਂ ਦੋਨਾਂ ਦੇ ਵਿੱਚ ਖੇਡੀਆਂ ਜਾਂਦੀਆਂ ਹਨ